ਸਮੇਂ ਦੇ ਅਨੁਸਾਰ ਯੋਗ ਦਾ ਕਾਫੀ ਵਿਕਾਸ ਹੋਇਆ ਹੈ ਪਹਿਲੇ ਟਾਈਮ ਤੇ ਯੋਗ ਕਾਫੀ ਲੋਕ ਘੱਟ ਲੋਕ ਕਰਦੇ ਹੁੰਦੇ ਸਨ ਪਰ ਇੱਕੀ ਜੂਨ ਇੱਕੀ ਜੂਨ ਪੂਰੇ ਵਿਸ਼ਵ ਭਰ ਯੋਗ ਦਿਵਸ ਮਨਾਇਆ ਜਾਂਦਾ ਹੈ ਜਿੱਥੇ ਕਾਫੀ ਲੋਕ ਇਕੱਠ ਹੋ ਕੇ ਯੋਗ ਇੱਕ ਖੁੱਲੇ ਮੈਦਾਨ ਵਿੱਚ ਯੋਗ ਕਰਦੇ ਹਨ ਤੇ ਨਾਲ ਨਾਲ ਯੋਗਾ ਕਰਨ ਨਾਲ ਸਾਡੇ ਸਾਡਾ ਦਿਨ ਚਰਿਆ ਵਧੀਆ ਹੁੰਦਾ ਹੈ ਯੋਗਾ ਦਾ ਕਾਫੀ ਵਿਕਾਸ ਹੋਇਆ ਹੈ ਡੇਅ ਬਾਈ ਡੇਅ ਜਿਵੇਂ ਸਚੇ ਯੋਗਾ ਦਾ ਵਿਕਾਸ ਕਰਨ ਤੇ ਸਭ ਤੇ ਜਿਆਦਾ ਯੋਗਦਾਨ ਭਾਰਤ ਦਾ ਹੈ ਭਾਰਤ ਨੇ ਪਹਿਲੀ ਵਾਰ ਪੂਰੇ ਵਰਲਡ ਵਿੱਚ ਸੰਸਾਰ ਵਿੱਚ ਯੋਗਾ ਦਿਵਸ ਮਨਾਇਆ ਸੀ ਜਿਸ ਕਰਕੇ ਇਹ ਇਹ ਦਿਨ ਪੂਰੇ ਸੰਸਾਰ ਵਿੱਚ ਫੈਲਿਆ ਤੇ ਲੋਕੀ ਵੀ ਮਨਾਉਣ ਲੱਗ ਗਏ ਤੇ ਕੰਟਰੀ ਵੀ ਮਨਾਉਣ ਲੱਗ ਗਈ ਤੇ ਜਿਸ ਕਰਕੇ ਯੋਗ ਦਾ ਵਿਕਾਸ ਹੋਇਆ ਹੈ